ਸਾਡਾ ਪੰਜਾਬ ਰਾਜ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਖੇਡਾਂ ਵਿੱਚ ਸਾਡੇ ਜੀਵਨ ਦਾ ਅਖਿੜਵਾਂ ਅਨਿੱਖੜਵਾਂ ਅੰਗ ਹੈ ਇਹਨਾਂ ਖੇਡਾਂ ਦੀ ਸਾਡੇ ਜੀਵਨ ਵਿੱਚ ਬਹੁਤ ਫ਼ਾਇਦੇ ਹਨ ਜਿਵੇਂ ਚੰਗੀ ਸਿਹਤ ਨਸ਼ਾ ਮੁਕਤ ਚੰਗੀ ਸੋਚਣ ਸ਼ਕਤੀ ਦਿਮਾਗੀ ਅਤੇ ਸਰੀਰਕ ਕਸਰਤ ਤੇ ਤੋਂ ਇਲਾਵਾ ਰੁਜ਼ਗਾਰ ਦਾ ਵੀ ਸਾਧਨ ਹਨ ਖੇਡਾਂ ਦੇ ਬਹੁਤ ਸਾਰੇ ਗੁਣ ਹਨ ਇਸ ਨਾਲ ਸਾਡੀ ਸਰੀਰ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ ਇਹਨਾਂ ਖੇਡਾਂ ਨਾਲ ਸਾਡੇ ਪੰਜਾਬ ਦਾ ਨਾਂ ਵਿਦੇਸ਼ਾਂ ਵਿੱਚ ਜਾਣਿਆ ਜਾਂਦਾ ਹੈ ਜਿੱਤਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਜਾਂਦੇ ਹਨ ਜਿਸ ਨਾਲ ਖਿਡਾਰੀ ਦਾ ਨਾਮ ਬਣ ਜਾਂਦਾ ਹੈ ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ ਇਸ ਤਰ੍ਹਾਂ ਟੀਮ ਦਾ ਤਾਲਮੇਲ ਬਣਾਉਣ ਖੇਡਾਂ ਤੋਂ ਹੀ ਸਿੱਖਿਆ ਜਾਂਦਾ ਹੈ ਖਿਡਾਰਿਆਂ ਨੂੰ ਹੋਰ ਕਈ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਇਹਨਾਂ ਸਾਰੀਆਂ ਸਹੂਲਤਾਂ ਨੂੰ ਦੇਖ ਕੇ ਹੋਰ ਖਿਡਾਰੀ ਪ੍ਰੇਰਿਤ ਹੁੰਦੇ ਹਨ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਂਦੇ ਹਨ